ਕੱਪੜੇ ਦਾ ਡਿਜ਼ਾਇਨ ਸਭ ਤੋਂ ਪਹਿਲਾਂ ਸਰੀਰਿਕ ਬਣਤਰ ਅਤੇ ਉਮਰ ਦੇ ਹਿਸਾਬ ਨਾਲ਼ ਚੁਣਿਆ ਜਾਂਦਾ ਹੈ ਇਸ ਦੇ ਵਿੱਚ ਵਿੱਚ ਮੇਰੀ ਆਪਣੀ ਸੋਚ ਹੁੰਦੀ ਹੈ ਮੈਂ ਆਪਣੇ ਵਿਚਾਰਾਂ ਦੇ ਆਧਾਰ 'ਤੇ ਆਪਣੇ ਲਈ ਡਿਜ਼ਾਅਨ ਤਿਆਰ ਕਰਦੀ ਹਾਂ ਮੈਨੂੰ ਆਪਣੇ ਖੁਦ ਦੇ ਡਿਜ਼ਾਇਨ ਕੀਤੇ ਕੱਪੜੇ ਬਹੁਤ ਪਸੰਦ ਆਉਂਦੇ ਹਨ